ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਹਾਂ ਪੁੱਛ ਅੱਛਾ ਅੱਛਾ ਸਾਡੇ ਲਾਗੇ ਗਵਾਂਢ 'ਚ ਤਾਂ ਮੇਰੇ ਬੱਚੇ ਵੀ ਤਾਂ ਸਾਰੇ ਪੀ ਸੀ ਏ 'ਚ ਹੀ ਪੜ੍ਹੇ ਆ ਪੰਜਾਬ ਚਿਲਡਰਨ ਅਕੈਡਮੀ ਆ ਨਾ ਇੱਥੇ ਗੋਇੰਦਵਾਲ ਰੋਡ 'ਤੇ ਬੜਾ ਵਧੀਆ ਜੀ ਕੁਛ ਵੀ ਨਹੀਂ ਟੈਨਸ਼ਨ ਹੁੰਦੀ ਭੈਣ ਇੰਨਾ ਬੱਚੇ ਨੂੰ ਤਿਆਰੀ ਕਰਵਾਉਂਦੇ ਆ ਵਧੀਆ ਨੰਬਰ ਲੈ ਜਾਂਦੇ ਨੇ ਰਿਜਲਟ ਵੀ ਇਹਨਾਂ ਦਾ ਵਧੀਆ ਹੈ ਮੈਡਮਾਂ ਵੀ ਬੜੀਆਂ ਚੰਗੀਆਂ ਈ ਹਾਂ ਹਾਂ ਉਹਨਾਂ ਨੇ ਤਿਆਰੀ ਉਸ ਹਿਸਾਬ ਨਾਲ ਕਰਵਾਉਣੀ ਹੁੰਦੀ ਆ ਜਦੋਂ ਆਪਾਂ ਸ਼ੁਰੂ ਤੋਂ ਹੀ ਬੱਚਾ ਉੱਥੇ ਪਾਉਣਾ ਵਾ ਤਾਂ ਫਿਰ ਸਾਨੂੰ ਕਾਹਦੀ ਟੈਂਸ਼ਨ ਆ ਉਹ ਤਾਂ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਨੇ ਵੀ ਵਿੱਚੋਂ ਕਿਸੇ ਹੋਰ ਸਕੂਲ ਤੋਂ ਲਿਆ ਕੇ ਪਾਉਣਾ ਹੈ ਹਾਂ ਆਉਂਦੀ ਆਉਂਦੀ ਆ ਆਉਂਦੀ ਉਹ ਵੈਨਾਂ ਲਾਈਆਂ ਹੋਈਆਂ ਈ ਉੱਥੇ ਕਿੰਨੀਆਂ ਹੀ ਆ ਨਹੀਂ ਵਾਧੂ ਆ ਪਿੰਡਾਂ ਦੇ ਬੱਚੇ ਵਾਧੂ ਆਉਂਦੇ ਆ ਉੱਥੇ

ਚਲੋ ਉਹ ਮੈਂ ਤੈਨੂੰ ਨਾ ਦਾਖਲੇ ਦਾ ਕੱਲ੍ਹ ਸਾਰਾ ਨਾ ਸਾਡੇ ਗੁਆਂਢ 'ਚ ਜਿਹੜਾ ਮੁੰਡਾ ਜਾਂਦਾ ਨਾ ਕੱਲ੍ਹ ਉਹਦੇ ਕੋਲੋਂ ਫੋਨ ਨੰਬਰ ਮੰਗਾਉਂਦੀ ਆ ਸਕੂਲ ਦਾ ਅਤੇ ਫਿਰ ਮੈਂ ਤੈਨੂੰ ਭੇਜਦੀ ਆ ਮਤਲਬ ਉਹਦੇ ਕੋਲੋਂ ਪੁੱਛ ਕੇ ਤਾਂ ਫਿਰ ਮੈਂ ਤੈਨੂੰ ਮੈਸਿਜ਼ ਕਰ ਛੱਡਾਗੀਂ ਵ੍ਹਟਸਐਪ 'ਤੇ ਆਹੋ ਮੈਂ ਤੇਰੇ ਨਾਲ ਚੱਲ ਪਊਂਗੀ ਕੋਈ ਗੱਲ ਨਹੀਂ ਹਾਂ ਆਪਾਂ ਚੱਲ ਪਾਂਗੇ ਆਹ ਮੈਡਮਾਂ ਵੀ ਚੰਗੀਆਂ ਵਾ ਪ੍ਰਿੰਸੀਪਲ ਬੜੀ ਚੰਗੀ ਓ ਵਧੀਆ ਨੇ ਜਾ ਕੇ ਦੇਖ ਕੇ ਆਉਂਦੀ ਹਾਂ ਕੱਲ੍ਹ ਕੀ ਕਹਿੰਦੇ ਆ ਹਾਂ ਚਲ ਠੀਕ ਆ ਹਾਂ ਹਾਂ ਹਾਂ ਜ਼ਰੂਰ ਜ਼ਰੂਰ ਓਕੇ ਸਤਿ ਸ਼੍ਰੀ ਅਕਾਲ